ਹਾਂਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਵੈਸੇ ਤਾਂ ਮੈਂ ਇੱਕ ਕਿਸਾਨ ਹਾਂ ਅਤੇ ਮੇਰਾ ਜਿਹੜਾ ਸਰੀਰ ਆ ਉਹ ਫਿਟ ਰਹਿੰਦਾ ਕਿਉਂਕਿ ਮੈਂ ਚੌਵੀ ਘੰਟੇ ਖੇਤਾਂ ਵਿੱਚ ਹੀ ਕੰਮ ਕਰਦਾ ਹਾਂ ਅਤੇ ਫਿਰ ਵੀ ਮੈਂ ਆਪਣੀ ਬੋਡੀ ਲਈ ਅ ਅੱਧਾ ਪੌਣਾ ਘੰਟਾ ਸਵੇਰੇ ਕੱਢਦਾ ਹਾਂ ਜਿਸ ਦੇ ਵਿੱਚ ਮੈਂ ਰਨਿੰਗ ਕਰਦਾ ਹਾਂ ਰਨਿੰਗ ਕਰਕੇ ਮੈਨੂੰ ਬਹੁਤ ਹੀ ਆਨੰਦ ਮਿਲਦਾ ਹੈ ਮੈਂ ਦੌੜਨ ਦੇ ਲਈ ਖੇਤਾਂ ਵਿੱਚ ਕੱਚੇ ਰਾਹਾਂ ਉੱਤੇ ਜਾਂਦਾ ਹਾਂ ਜਿੱਥੇ ਕਿ ਮੈਨੂੰ ਤਾਜ਼ੀ ਹਵਾ ਮਿਲਦੀ ਹੈ ਅਤੇ ਮੈਨੂੰ ਦੌੜਨਾ ਬਹੁਤ ਚੰਗਾ ਲੱਗਦਾ ਹੈ ਇਸ ਨਾਲ ਮੇਰੀ ਸਿਹਤ ਬਹੁਤ ਵਧੀਆ ਰਹਿੰਦੀ ਹੈ ਮੈਨੂੰ ਕਿਸੇ ਕਿਸਮ ਦਾ ਕੋਈ ਵੀ ਬਿਮਾਰੀ ਨਹੀਂ ਹੁੰਦੀ ਅਤੇ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਹਾਂ ਕਿ ਚਾਹੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਪਰ ਅੱਧਾ ਘੰਟਾ ਆਪਣੇ ਸਰੀਰ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਇਸ ਨਾਲ ਹੀ ਆਪਣਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹਿ ਸਕਦਾ ਹੈ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਾਨੂੰ ਡਾਕਟਰਾਂ ਕੋਲ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਮਹੀਨੇ ਮੈਨੂੰ ਕਈ ਦਿਨ ਕਾ ਦਿਨਾਂ ਦੇ ਕਾਰਨ ਚੰਡੀਗੜ੍ਹ ਜਾਣਾ ਪੈ ਗਿਆ ਅਤੇ ਮੈਨੂੰ ਸੈਰ ਨਹੀਂ ਕਰਨ ਕਰਨੀ ਪਈ ਜਾਂ ਕਰ ਨਹੀਂ ਸਕਿਆ ਮੇਰਾ ਸਰੀਰ ਇਸ ਤਰ੍ਹਾਂ ਹੋ ਗਿਆ ਵੀ ਪਤਾ ਨਹੀਂ ਕਿੰਨਾ ਕੁ ਭਾਰਾ ਹੋ ਗਿਆ ਪਰ ਫਿਰ ਮੈਂ ਚਾਰ ਦਿਨਾਂ ਬਾਅਦ ਜਦੋਂ ਸੈਰ ਕੀਤੀ ਤਾਂ ਮੇਰੀ ਜਿਹੜੀ ਬੋਡੀ ਸੀ ਉਸ ਨੂੰ ਇੰਨਾ ਅਰਾਮ ਮਿਲਿਆ ਕਿ ਬਹੁਤ ਵੱਡਾ ਜਿਹੜਾ ਭਾਰ ਸੀ ਉਹ ਮੇਰੇ ਸਰੀਰ ਤੋਂ ਲਹਿ ਗਿਆ ਦੱਸਣ ਤੋਂ ਭਾਵ ਇਹ ਹੈ ਵੀ ਆਪਾਂ ਕੋਈ ਵੀ ਕੰਮ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਜਦੋਂ ਆਪਾਂ ਕੰਮ ਬੰਦ ਕਰਦੇ ਹਾਂ ਤਾਂ ਆਪਣੀ ਬੋਡੀ ਨੂੰ ਇੱਕ ਝਟਕਾ ਲੱਗਦਾ ਹੈ ਵੀ ਕੁਝ ਰਹਿ ਗਿਆ ਹੈ ਤਾਂ ਇਸ ਤਰ੍ਹਾਂ ਮੇਰਾ ਜਿਹੜਾ ਸਰੀਰ ਸੀ ਉਹ ਬਹੁਤ ਫਿੱਟ ਹੈ ਅਤੇ ਮੈਂ ਰਨਿੰਗ ਕਰਦਾ ਹਾਂ ਯੋਗਾ ਕਰਦਾ ਹਾਂ ਸਕਿਪਿੰਗ ਕਰਦਾ ਹਾਂ ਇਸ ਤਰ੍ਹਾਂ ਕਰਨ ਨਾਲ ਮੇਰੀ ਬੋਡੀ ਨੂੰ ਬਹੁਤ ਅਰਾਮ ਮਿਲਦਾ ਹੈ ਅਤੇ ਮੈਂ ਯੋਗਾ ਕਰਕੇ ਹੀ ਖਾਣਾ ਖਾਂਦਾ ਹਾਂ ਜਿਸ ਨਾਲ ਮੇਰਾ ਜਿਹੜਾ ਖਾਣਾ ਹੈ ਉਹ ਜਲਦੀ ਪਚ ਜਾਂਦਾ ਹੈ ਫਿਰ ਮੈਂ ਖੇਤਾਂ ਵਿੱਚ ਜਾ ਕੇ ਕਸਰਤ ਕਰਦਾ ਹਾਂ ਕਹੀ ਚਲਾਉਂਦਾ ਹਾਂ ਅਤੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਖੇਤਾਂ ਵਿੱਚ ਹੁੰਦੇ ਨੇ ਉਹ ਬਹੁਤ ਜ਼ਿਆਦਾ ਤਰੀਕੇ ਨਾਲ ਕਰਨੇ ਪੈਂਦੇ ਹਨ ਜਿਸ ਨਾਲ ਮੇਰਾ ਸਰੀਰ ਫਿਟ ਰਹਿੰਦਾ ਹੈ ਧੰਨਵਾਦ